ਭੰਗੜੇ ਦੇ ਬਹੁਤ ਸਾਰੇ ਸਟੈਪ ਹਨ ਭੰਗੜਾ ਚਾਲ ਸੰਮੀ ਟੁੱਗੀ ਧਮਾਲ ਆਦਿ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਭੰਗੜੇ ਦੇ ਨਾਲ ਲੋਕਾਂ ਵਿੱਚ ਇੱਕ ਵੱਖਰਾ ਹੀ ਜੋਸ਼ ਆ ਜਾਂਦਾ ਹੈ ਢੋਲ ਦੀ ਤਾਲ 'ਤੇ ਸਭ ਥਿਰਕਣ ਲੱਗ ਪੈਂਦੇ ਹਨ ਧਮਾਲ ਤਾਂ ਭੰਗੜੇ ਦੀ ਜਾਨ ਹੈ ਜਿਸ ਨਾਲ ਢੋਲ 'ਤੇ ਬਹੁਤ ਹੀ ਜਸ਼ਨ ਸ਼ੁਰੂ ਹੋ ਜਾਂਦਾ ਹੈ